ਸਾਡੇ ਖੇਤਰ ਦੇ ਅਗਰ ਇਤਿਹਾਸ ਵਿੱਚ ਜਾਈਏ ਤਾਂ ਸਾਡੇ ਜਿਹੜਾ ਖੇਤਰ ਹੈਗਾ ਇਸ 'ਤੇ ਜਿਹੜਾ ਮੇਨ ਤੌਰ 'ਤੇ ਜਿਹੜਾ ਰਾਜਵੰਸ਼ ਰਿਹਾ ਜਿਨ੍ਹਾਂ ਨੇ ਸਾਡੇ ਇਸ 'ਤੇ ਜੋ ਰਾਜ ਕੀਤਾ ਹੈ ਉਹ ਮਹਾਰਾਜਾ ਪਟਿਆਲਾ ਸੀਗੇ ਮਹਾਰਾਜਾ ਭੁਪਿੰਦਰ ਸਿੰਘ ਜੀ ਜਿਨ੍ਹਾਂ ਦੇ ਵੱਲੋਂ ਸਾਡੇ ਜਿਹੜਾ ਖੇਤਰ 'ਤੇ ਹੈਗਾ ਇਹਨਾਂ 'ਤੇ ਰਾਜ ਕੀਤਾ ਹੈ